ਜਦੋਂ ਕਦੇ ਅਸੀਂ ਥੋੜ੍ਹੇ ਦਿਨਾਂ ਲਈ ਬਾਹਰ ਜਾਂਦੇ ਹਾਂ ਇਸ ਵਿਸ਼ੇ 'ਤੇ ਮੈਂ ਤੁਹਾਨੂੰ ਆਪਣੇ ਘਰ ਦੀ ਹੱਡਬੀਤੀ ਦੱਸਣਾ ਚਾਹੁੰਦੀ ਹਾਂ ਅਸੀਂ ਪਹਿਲੀ ਗੱਲ ਤਾਂ ਘਰ ਦੇ ਪੂਰੇ ਸਾਰੇ ਫੈਮਿਲੀ ਮੈਂਬਰ ਕਦੇ ਵੀ ਇਕੱਠੇ ਬਾਹਰ ਨਹੀਂ ਜਾਂਦੇ ਸਾਡੇ ਘਰ 'ਚ ਅਕਸਰ ਕੋਈ ਨਾ ਕੋਈ ਵਿਅਕਤੀ ਘਰ ਹੀ ਹੁੰਦਾ ਹੈ ਅਤੇ ਜੇ ਕਦੇ ਅਸੀਂ ਕਦੇ ਚਲੇ ਵੀ ਜਾਈਏ ਸਾਰੇ ਫੈਮਲੀ ਮੈਂਬਰ ਤਾਂ ਅਸੀਂ ਆਪਣੇ ਘਰ ਦੀਆਂ ਚਾਬੀਆਂ ਨੇ ਉਹ ਅਕਸਰ ਅਸੀਂ ਆਪਣੇ ਗੁਆਂਡੀਆਂ ਨੂੰ ਦੇ ਕੇ ਜਾਂਦੇ ਹਾਂ ਤਾਂ ਕੀ ਸਾਡੇ ਜਾਣ ਪਿੱਛੋਂ ਕੁਛ ਵੀ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਸਾਡੇ ਘਰ ਦੇ ਦੇ ਵਿੱਚ ਜੋ ਵੀ ਹੋ ਰਿਹਾ ਸਾਡੇ ਗਵਾਂਢੀ ਦੇਖ ਸਕਣ ਅਤੇ ਸਾਡੇ ਜਾਣ ਤੋਂ ਬਾਅਦ ਜਿਹੜੇ ਸਾਡੇ ਪਿਆਰੇ ਪਿਆਰੇ ਪੌਦੇ ਐਂ ਉਹਨਾਂ ਦੀ ਦੇਖਭਾਲ ਵੀ ਸਾਡੇ ਗੁਆਂਢੀ ਹੀ ਕਰਦੇ ਹਨ ਅਸੀਂ ਉਹਨਾਂ ਨੂੰ ਬੋਲ ਕੇ ਜਾਂਦੇ ਹਾਂ ਕਿ ਸਾਡੇ ਪੌਦਿਆਂ ਨੂੰ ਸਵੇਰੇ ਪਾਣੀ ਜ਼ਰੂਰ ਦੇਣਾ ਹੈ ਅਤੇ ਜੇ ਕਦੇ ਉਹ ਭੁੱਲ ਵੀ ਜਾਂਦੇ ਨੇ ਅਤੇ ਅਸੀਂ ਉਹਨਾਂ ਨੂੰ ਫੋਨ ਰਾਹੀਂ ਸੰਪਰਕ ਕਰਕੇ ਯਾਦ ਦਵਾ ਦਿੰਦੇ ਹਾਂ ਕਿ ਸਾਡੇ ਪੋਦਿਆਂ ਨੂੰ ਪਾਣੀ ਦੇ ਦਿਉ ਇਸ ਤੋਂ ਇਲਾਵਾ ਬਾਕੀ ਸਾਡੇ ਦੇ ਘਰ ਦੀ ਦੇਖਭਾਲ ਵੀ ਸਾਡੇ ਜਾਣ ਪਿੱਛੋਂ ਸਾਡੇ ਗੁਆਂਢੀ ਹੀ ਕਰਦੇ ਹਨ